ਹੈਲੋ ਹਾਂਜੀ ਸਰ ਮੈਂ ਨਾ ਇੱਥੇ ਇੱਕ ਟੂਰਿਸਟ ਹਾਂ ਮੈਂ ਨਵੀਂ ਹਾਂ ਅਤੇ ਮੈਨੂੰ ਦੱਸਿਓ ਕਿ ਇੱਕ ਏਅਰਪੋਟ ਕੋਈ ਕੋਈ ਹੈਗਾ ਟੂਰਿਸਟ ਹਾਂਜੀ

ਅੱਛਾ ਜੀ ਹਾਂਜੀ ਏਅਰਪੋਟ 'ਤੇ ਜਾਣਾ ਹੋਵੇ ਤਾਂ ਕਿ ਮੈਨੂੰ ਟੈਕਸੀ ਵਗੈਰਾ ਜਾਂ ਕਰਨਾ ਜਾਂ ਬੱਸ ਅੱਡੇ ਜਾਣਾ ਬੱਸ 'ਤੇ ਜਾਣਾ ਜਾਂ ਟੈਕਸੀ ਕਰਕੇ ਜਾਣਾ ਮੈਨੂੰ ਕਿਹ 'ਤੇ ਸਹੀ ਰਹੇਗਾ ਹਾਂਜੀ

ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਹਾਂਜੀ ਸਰ ਜੇ ਮੈਂ ਉੱਥੇ 'ਤੇ ਜਾਣਾ ਹੋਵੇ ਤਾਂ ਮੈਨੂੰ ਟੈਕਸੀ ਕਰਕੇ ਸਹੀ ਰਹੇਗਾ ਜਾਂ ਬੱਸ 'ਤੇ ਜਾਣਾ ਸਹੀ ਰਹੇਗਾ ਮੈਨੂੰ ਕਿਰਾਇਆ ਵੀ ਜਾਇਜ਼ ਹੋਵੇ ਅਤੇ ਕੰਫਰਟ ਅ ਠੀਕ ਹੈ ਅਤੇ ਮੈਂ ਕੰਫ਼ਰਟੇਬਲ ਵੀ ਜਾ ਸਕਾਂ

ਅੱਛਾ ਜੀ ਓਕੇ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਫਿਰ ਆਪਣੀ ਟੈਕਸੀ ਸਹੀ ਰਹੇਗੀ ਨਾ ਤੁਹਾਡੇ ਹਿਸਾਬ ਨਾਲ ਪਲੇਸਸ ਹੁਸ਼ਿਆਰਪੁਰ 'ਚ ਕਿਹੜੇ ਕਿਹੜੇ ਵਧੀਆ ਦੇਖਣ ਨੂੰ ਠੀਕ ਹੈ ਅਤੇ ਅਤੇ ਅਤੇ ਠੀਕ ਹੈ ਅਤੇ ਖਾਣ ਪੀਣ ਦਾ ਵੀ ਉੱਥੇ ਪ੍ਰਬੰਧ ਹੋਵੇਗਾ ਜਾਂ ਨਹੀਂ ਅੱਛਾ ਜੀ ਰੈਸਟੋਰੈਂਟ ਵੀ ਪਹੁੰਚ ਕੇ ਉੱਥੇ ਫਿਰ ਘੁੰਮਣ ਫਿਰਨ ਨੂੰ ਵੀ ਜਗ੍ਹਾ ਸਾਨੂੰ ਵਧੀਆ ਦੇਖਣ ਵਾਸਤੇ ਅੱਛਾ ਜੀ ਚੱਲੋ ਠੀਕ ਹੈ ਜੀ ਫਿਰ